ਟੈਕਨੋਲਜੀ ਅਤੇ ਇੰਟਰਨੈਟ ਰਾਹੀਂ ਪੰਜਾਬੀ ਦਾ ਸੰਚਾਰ ਵੱਧ ਰਿਹਾ ਹੈ ਜਿਵੇਂ ਕਿ ਗੂਗਲ ਯੂਟਿਊਬ ਵਿਕੀਪੀਡੀਆ ਇਹ ਸਾਰੀ ਸਾਈਟਸ ਲੋਕਾਂ ਨੂੰ ਕਾਫੀ ਮਦਦ ਕਰ ਰਹੀਆਂ ਨੇ ਪੰਜਾਬੀ ਭਾਸ਼ਾ ਸਿੱਖਣ ਵਾਸਤੇ ਪੰਜਾਬੀ ਸੱਭਿਆਚਾਰ ਪੰਜਾਬੀ ਸਿਕਸ਼ਾ ਪੰਜਾਬੀ ਭਾਸ਼ਾ ਇਹ ਸਭ ਕੁਝ ਗੂਗਲ ਯੂਟਿਊਬ ਅਤੇ ਵਿਕੀਪੀਡੀਆ ਸਿਖਾ ਸਕਦਾ ਹੈ ਕਾਫੀ ਯੂਟਿਊਬ ਚੈਨਲਸ ਲੋਕਾਂ ਨੂੰ ਮਦਦ ਕਰਦੇ ਨੇ ਪੰਜਾਬੀ ਭਾਸ਼ਾ ਸਿੱਖਣ ਵਾਸਤੇ ਬਿਲਕੁਲ ਸ਼ੁਰੂ ਤੋਂ ਮਤਲਬ ਜਿਸ ਕਿਸੇ ਨੂੰ ਪੰਜਾਬੀ ਦਾ ਇੱਕ ਅੱਖਰ ਵੀ ਨਹੀਂ ਆਉਂਦਾ ਉਹ ਵੀ ਪੰਜਾਬੀ ਭਾਸ਼ਾ ਪੂਰੀ ਚੰਗੀ ਤਰ੍ਹਾਂ ਸਿੱਖ ਸਕਦਾ ਹੈ ਉਸ ਤੋਂ ਬਾਅਦ ਜੇ ਆਪਾਂ ਗੂਗਲ ਦੀ ਗੱਲ ਕਰੀਏ ਤਾਂ ਗੂਗਲ ਪੰਜਾਬੀ ਭਾਸ਼ਾ ਬਾਰੇ ਹਰ ਚੀਜ਼ ਦੱਸ ਦਿੰਦਾ ਹੈ ਉਸਦੇ ਰਾਹੀਂ ਆਪਾਂ ਪੰਜਾਬੀ ਭਾਸ਼ਾ ਬਾਰੇ ਸਭ ਕੁਛ ਪੜ੍ਹ ਸਕਦੇ ਹਾਂ ਜਿਵੇਂ ਕਿ ਪੰਜਾਬੀ ਸਿਕਸ਼ਾ ਦੇ ਅੰਦਰ ਕੀ ਕੀ ਇਸਤੇਮਾਲ ਹੋ ਰਿਹਾ ਹੈ ਅਤੇ ਪੰਜਾਬੀ ਭਾਸ਼ਾ ਦਾ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ ਉਹਦੇ ਰਾਹੀਂ ਜਿਹੜੇ ਲੋਕ ਭਾਰਤ ਤੋਂ ਬਾਹਰ ਰਹਿ ਰਹੇ ਹਨ ਉਹ ਵੀ ਪੰਜਾਬੀ ਭਾਸ਼ਾ ਸਿੱਖ ਸਕਦੇ ਨੇ ਜਿਵੇਂ ਹੀ ਉਹ ਲੋਕ ਪੰਜਾਬੀ ਭਾਸ਼ਾ ਸਿੱਖਦੇ ਨੇ ਉਹ ਵੀ ਉਵੇਂ ਉਹਦਾ ਉਪਯੋਗ ਹੋਰ ਵੱਧ ਵੱਧਦਾ ਰਹਿੰਦਾ ਹੈ ਇਸ ਤਰੀਕੇ ਨਾਲ ਪੰਜਾਬੀ ਭਾਸ਼ਾ ਦੇ ਅੰਦਰ ਜੋ ਵੀ ਬਦਲਾਵ ਆ ਰਿਹਾ ਹੈ ਉਹ ਸਾਰਾ ਗੂਗਲ ਜਾਂ ਯੂਟਿਊਬ ਰਾਹੀਂ ਹੀ ਆ ਰਿਹਾ ਹੈ ਜੇ ਕੋਈ ਪੰਜਾਬੀ ਭਾਸ਼ਾ ਬਾਰੇ ਹੋਰ ਕੁਛ ਵੀ ਸਿੱਖਣਾ ਚਾਹੁੰਦਾ ਹੈ ਤਾਂ ਫਿਰ ਉਹ ਵਿਕੀਪੀਡੀਆ 'ਤੇ ਵੀ ਦੇਖ ਸਕਦਾ ਹੈ ਵਿਕੀਪੀਡੀਆ ਲੋਕਾਂ ਨੂੰ ਬਹੁਤ ਮਦਦ ਕਰ ਰਿਹਾ ਹੈ ਪੰਜਾਬੀ ਭਾਸ਼ਾ ਸਿੱਖਣ ਵਾਸਤੇ